ਮੋਰ ਮੋਰ ਦਾ ਕੱਦ ਬਹੁਤ ਵੱਡਾ ਹੁੰਦਾ ਹੈ ਮੋਰ ਜੋ ਕਿ ਬਹੁਤ ਸੋਹਣਾ ਹੁੰਦਾ ਹੈ ਪਾਇਲ ਪਾਂਦਾ ਮੋਰ ਬਹੁਤ ਚੰਗਾ ਲੱਗਦਾ ਹੈ ਮੋਰ ਨੂੰ ਰਾਸ਼ਟਰੀ ਪੰਛੀ ਵੀ ਕਿਹਾ ਜਾਂਦਾ ਹੈ ਮੋਰ ਪਿੰਡਾਂ ਦੇ ਵਿੱਚ ਦਰੱਖਤਾਂ ਦੇ ਉੱਤੇ ਬੈਠਦਾ ਹੈ ਤੇ ਇਸ ਨੂੰ ਜਦੋਂ ਸ਼ਾਮ ਨੂੰ ਆ ਕੇ ਘਰਾਂ ਦੇ ਬਾਹਰ ਆ ਕੇ ਪਾਇਲ ਪਾਉਂਦਾ ਦਰਖਤ ਤੋਂ ਬਾਹਰਲੇ ਪਾਸੇ ਪਾਇਲ ਪਾਉਂਦਾ ਤਾਂ ਉਸ ਟਾਈਮ ਬਹੁਤ ਸੋਹਣਾ ਲੱਗਦਾ ਹੈ ਮੋਰ ਦੇ ਜਿਹੜੇ ਪੈਰ ਹੁੰਦੇ ਨੇ ਨਾ ਉਹ ਤੁਹਾਡੇ ਪੈਰਾਂ ਦਾ ਸ਼ਕਲ ਸੋਹਣੀ ਨਹੀਂ ਗਿਣੀ ਜਾਂਦੀ ਹੈਗੀ ਤਾਂ ਮੋਰ ਉੱਪਰੋਂ ਬਹੁਤ ਜਿਆਦਾ ਸੋਹਣਾ ਹੁੰਦਾ ਤੇ ਪੈਰ ਥੋੜੇ ਭੱਦੇ ਗਿਣੇ ਗਏ ਨੇ ਮੋਰ ਮੋਰ ਮੋਰ ਨੂੰ ਅਸੀਂ ਰਾਸ਼ਟਰੀ ਪੰਛੀ ਕਹਿੰਦੇ ਆਂ ਮੋਰ ਮੋਰ ਪੰਛੀਆਂ ਦੇ ਵਿੱਚੋਂ ਬਹੁਤ ਸੋਹਣਾ ਇਸ ਦੇ ਖੰਭ ਬਹੁਤ ਕੰਮ ਆਉਂਦੇ ਨੇ ਖੰਭਾਂ ਦੇ ਲੋਕੀ ਬਣਾ ਕੇ ਗਮਲੇ ਬਣਾ ਕੇ ਆਪਣੇ ਕੀ ਕਹਿੰਦੇ ਹੁੰਦੇ ਨੇ ਸ਼ੋਪੀਸ ਬਣਾ ਕੇ ਇਦਾਂ ਬਣਾ ਕੇ ਰੱਖਦੇ ਨੇ ਮੋਰ ਦਾ ਮੋਰ ਦਾ ਖੰਭ ਘਰ ਦੇ ਵਿੱਚ ਰੱਖਣ ਨਾਲ ਕਿਰਲੀ ਛਿਪਕਲੀ ਵਗੈਰਾ ਨਹੀਂ ਆਉਂਦੀਆਂ ਹਨ ਮੋਰ ਨੂੰ ਮੋਰ ਦੇ ਖੰਭਾਂ ਦੇ ਨਾਲ ਦਾ ਪੰਖ ਬਣਾ ਜੋੜ ਕੇ ਉਹਨਾਂ ਦਾ ਪੰਖਾ ਬਣਾਇਆ ਜਾਂਦਾ ਹੈ ਜੋ ਕਿ ਹਵਾ ਝੱਲਣ ਦੇ ਕੰਮ ਵੀ ਆਉਂਦਾ ਹੈ